ਹੈਲੋ ਹਾਂਜੀ ਕੋਣ ਓ ਅੱਛਾ ਓ ਅਨਮ ਹਾਂਜੀ ਹਾਂਜੀ ਵੀਰੇ ਕੀ ਹਾਲ ਆ

ਹਾਂਜੀ ਹਾਂਜੀ ਵੀਰੇ ਜ਼ਰੂਰ ਬਾਈ ਜੀ ਦੱਸਾਂਗੇ ਆਪਣਾ ਫੇਮਸ ਬੇਕਰ ਇੱਕ ਹੈਗਾ ਨੇਸ਼ਨਲ ਬੇਕਰ ਉਹਦੇ ਬਾਈ ਤੁਸੀਂ ਕੱਪ ਕੇਕਸ ਅਤੇ ਕੋਲਡ ਕੋਫੀ ਬਹੁਤ ਜ਼ਿਆਦਾ ਮਤਲਬ ਕਿ ਡਿਲੀਸ਼ੀਅਸ ਹੁੰਦੀ ਹੈ ਬਹੁਤ ਜ਼ਿਆਦਾ ਯੰਮੀ ਹੁੰਦੀ ਆ ਠੀਕ ਆ ਵੀਰੇ ਅਤੇ ਇਹ ਮਤਲਬ ਕਿ ਕੋਟਕਪੁਰਾ ਰੋਡ 'ਤੇ ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਹੈ ਜੀ ਠੀਕ ਆ ਅਤੇ ਇੱਕ ਹੈਗਾ ਆਪਣਾ ਨਵ ਬੇਕਰਸ ਜੀ ਨਵ ਬੇਕਰਸ ਦਾ ਕੇਕ ਬਈ ਕੇਕ ਬਹੁਤ ਜ਼ਿਆਦਾ ਸਵਾਦ ਹੁੰਦਾ ਉਹਨਾਂ ਦਾ ਅਤੇ ਮਤਲਬ ਕਿ ਬਹੁਤ ਜ਼ਿਆਦਾ ਜਿੱਦਾਂ ਉਹ ਨਹੀਂ ਹੁੰਦਾ ਮਤਲਬ ਕਿ ਪੇਸਟੀ ਉਹਨਾਂ ਦੀ ਬਹੁਤ ਸਵਾਦ ਹੁੰਦੀ ਹੈ ਠੀਕ ਆ ਨਾ ਤੁਸੀਂ ਉੱਥੋਂ ਦੀ ਵੀ ਕਰ ਸਕਦੇ ਉਹਨਾਂ ਦੀ ਨਵ ਬੇਕਰ ਕੀਤੇ ਬਹੁਤ ਚੰਗੇ ਕੇਕ ਬਣਾਉਂਦੇ ਨਾਲੇ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਬਾਈ ਇੱਕ ਹੁੰਦਾ ਹੈ ਬਾਹਲਾ ਹੀ ਯੰਮੀ ਹੁੰਦੇ ਹੈ ਅਤੇ ਆਪਾਂ ਇੱਕ ਗੋਰਾ ਗੁਲਸ਼ਨ ਬੇਕਰ ਆ ਜੀ ਗੋਰਾ ਗੁਲਸ਼ਨ ਅਤੇ ਬੇਕਰ ਬਾਈ ਉਹ ਮਤਲਬ ਕਿ ਪੈਟੀਸ ਵਗੈਰਾ ਨਾਲੋ ਬਹੁਤ ਬਹੁਤ ਜ਼ਿਆਦਾ ਫੇਮਸ ਸਾਰੇ ਮੁਕਤਸਰ 'ਚ ਉਹਨਾਂ ਦੀ ਪੈਟੀਆਂ ਦੀ ਸਿਫਤ ਹੁੰਦੀ ਹੈ ਬਹੁਤ ਸਾਰੇ ਮੁਕਤਸਰ 'ਚ ਹਾਂਜੀ ਆ ਪੈਟੀਆਂ ਦਾ ਉਹਨਾਂ ਕੋਲ ਇੱਕ ਆਲੂ ਪੈਟੀ ਹੁੰਦੀ ਆ ਇੱਕ ਮਿਕਸ ਵੈਜ ਪੈਟੀ ਹੁੰਦੀ ਹੈ ਬਟ ਉਹਨਾਂ ਦੀ ਮਿਕਸ ਵੈਜ ਪੈਟੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ ਅਤੇ ਉਹ ਮਤਲਬ ਕਿ ਬੰਨ ਵਗੈਰਾ ਅਤੇ ਬਿਸਕੁਟ ਵਗੈਰਾ ਵੀ ਬਣਾਉਂਦੇ ਨੇ ਅਤੇ ਬਹੁਤ ਜ਼ਿਆਦਾ ਕੁਆਲਿਟੀ ਵਧੀਆ ਹੁੰਦੀ ਆ ਉਹਨਾਂ ਦੀ ਅਤੇ ਬਹੁਤ ਸਵਾਦ ਹੁੰਦੇ ਹੈ ਅਤੇ ਇੱਕ ਆਪਣੇ ਢੋਡਾ ਬੇਕਰਸ ਆ ਗਿਆ ਢੋਡਾ ਬੇਕਰਸ ਵਿੱਚ ਢੋਡਾ ਬਾਈ ਬਹੁਤ ਸਵਾਦ ਬਣਾਉਦੇ ਕੋਟਕਪੁਰੇ ਮਿਲਦਾ ਆਪਣਾ ਇੱਕ ਢੋਡਾ ਉਹਨਾਂ ਤੋਂ ਵੀ ਸਵਾਦ ਕੋ ਕੁਆਲਿਟੀ ਵੀ ਵਧੀਆ ਨਾਲੇ ਸਵਾਦ ਵੀ ਵਧੀਆ ਜੀ ਇਹ ਮਤਲਬ ਕਿ ਢੋਡਾ ਬੇਕਰਸ ਆਪਣੇ ਆ ਜਾਂਦਾ ਬਠਿੰਡਾ ਰੋਡ ਉੱਤੇ ਚੌਂਕ ਕੋਲ ਅਤੇ ਗੋਰਾ ਗੁਲਸ਼ਨ ਆਪਣੇ ਬਠਿੰਡਾ ਰੋਡ 'ਤੇ ਇੱਧਰ ਕੋਟਕਪੁਰਾ ਚੌਂਕ ਵੱਲ ਆ ਜਾਂਦੇ ਬਠਿੰਡਾ ਰੋਡ ਵੱਲ ਕੀ ਲੈਣਾ ਵੀਰੇ ਇੱਥੇ ਆਪਾਂ ਨੂੰ ਆਪਾਂ ਨਵ ਬੇਕਰਸ ਤੋਂ ਲੈਣੀ ਚਾਹੀਦੀ ਹੈ ਵੀਰੇ ਬਹੁਤ ਡਿਲੀਸ਼ੀਅਸ ਹੁੰਦੀ ਹੈ ਉਹਨਾਂ ਦੀ ਹਾਂਜੀ ਵੀਰੇ ਅਤੇ ਇਹ ਯਾਰ ਉੱਥੇ ਐ ਡੋਕਟਰ ਕੇਹਰ ਸਿੰਘ ਚੌਂਕ ਹੈ ਨਾ ਮੁਕਤਸਰ 'ਚ ਬਸ ਡੋਕਟਰ ਕੇਹਰ ਸਿੰਘ ਕੇ ਕੇਹਰ ਸਿੰਘ ਚੌਂਕ ਹਾਂਜੀ ਹਾਂਜੀ ਅਤੇ ਬਾਈ ਉੱਥੋਂ ਲਿਓ ਬਾਈ ਬਹੁਤ ਜ਼ਿਆਦਾ ਡਿਲੀਸ਼ੀਅਸ ਆ ਅਤੇ ਮਤਲਬ ਕਿ ਦੱਸਿਓ ਖਾ ਕੇ ਤੁਸੀਂ ਜਿੰਨਾ ਕੁ ਸਵਾਦ ਲੱਗਿਆ ਅਤੇ ਹੋਰ ਵੀਰੇ ਹਾਂਜੀ ਹਾਂਜੀ ਵੀਰੇ ਆਏ ਨਹੀਂ ਤੁਸੀਂ ਮੁਕਤਸਰ ਵੀਰੇ ਅੱਛਾ ਵੀਰੇ ਕੋਈ ਨਾ ਵੀਰੇ ਆਪਾਂ ਘੁੰਮਾ ਦਾਂਗੇ ਤੁਹਾਨੂੰ ਸਾਰੇ ਬੇਕਰਸ ਤੋਂ ਹੀ ਤੁਸੀਂ ਕਰ ਲਿਓ ਆਪਣੀ ਵੀਡੀਓ ਸ਼ੂਟ ਚੱਲੋ ਠੀਕ ਹੈ ਵੀਰੇ ਓਕੇ ਵੀਰੇ